ਅਜ ਅੱਜ ਕੱਲ੍ਹ ਟੈਕਨੋਲੋਜੀ ਵਿੱਚ ਨਾ ਬਹੁਤ ਸਾਰੀਆਂ ਵੱਖ ਵੱਖ ਤਰੀਕੇ ਦੀਆਂ ਆਪਸ਼ਨਸ ਆ ਗਈਆਂ ਹਨ ਬ ਬਹੁਤ ਸਾਰੀਆਂ ਆਪਸ਼ਨਸ ਅਵੇਲੇਬਲ ਹਨ ਜਿਸ ਕਰਕੇ ਕਈ ਵਾਰੀ ਆਮ ਲੋਕਾਂ ਨੂੰ ਜਿਨ੍ਹਾਂ ਨੂੰ ਨਹੀਂ ਜ਼ਿਆਦਾ ਇਸ ਬਾਰੇ ਗਿਆਨ ਉਹਨਾਂ ਨੂੰ ਥੋੜ੍ਹਾ ਬਹੁਤੀ ਔਖਾ ਹੋ ਜਾਂਦਾ ਡਿਸੀਜ਼ਨ ਲੈਣਾ ਕਿ ਕਿਹੜੀ ਟੈਕਨੋਲਜੀ ਵੱਲ ਜਾਈਏ ਅਤੇ ਕਿਹੜੀ ਟੈਕਨੋਲਜੀ ਵੱਲ ਨਾ ਜਾਈਏ ਬਟ ਇਸ ਸਿਚੁਏਸ਼ਨ ਦਾ ਸਾਹਮਣਾ ਕਰਨ ਲਈ ਅੱਜ ਕੱਲ੍ਹ ਵੱਖ ਵੱਖ ਤਰੀਕੇ ਦੀਆਂ ਏ ਆਈ ਜਾਂ ਫਿਰ ਕਸਟਮਰ ਸਪੋਰਟ ਚਾਟ ਬੋਟ ਵਗੈਰਾ ਆ ਗਏ ਹਨ ਜਿਹੜੀ ਆਮ ਲੋਕਾਂ ਨੂੰ ਹੈਲਪ ਕਰਦੇ ਹਨ ਇਹ ਜਾਨਣ ਵਾਸਤੇ ਕਿ ਕਿਵੇਂ ਦੀ ਟੈਕਨੋਲੋਜੀ ਤੁਹਾਡੇ ਵਾਸਤੇ ਬੈਟਰ ਹੈ ਸੋ ਦੈਟ ਉਹਨਾਂ ਨੂੰ ਸ ਉਹ ਆਪਣੇ ਪੈਸੇ ਸਹੀ ਤਰੀਕੇ ਨਾਲ ਹੀ ਵਰਤਣ ਜਿੱਥੇ ਉਹਨਾਂ ਨੂੰ ਲੋੜ ਹੈ ਜਿਸ ਚੀਜ਼ ਦੀ ਉਹਨੂੰ ਉਹਨਾਂ ਨੂੰ ਲੋੜ ਆ ਉੱਥੇ ਹੀ ਪੈਸੇ ਉਹਨਾਂ ਦੇ ਲੱਗਣ ਅਤੇ ਉਹਨਾਂ ਦੇ ਪੈਸੇ ਬਰਬਾਦ ਨਾ ਹੋਣ ਅੱਜ ਕੱਲ੍ਹ ਬਹੁਤ ਸਾਰੇ ਸੇਵਾ ਕੇਂਦਰ ਬਣ ਗਏ ਹਨ ਜਿਸ ਕਰਕੇ ਉਹਨਾਂ ਨੂੰ ਬਹੁਤ ਇਸ ਬਾਰੇ ਗਿਆਨ ਮਿਲਦਾ ਹੈ ਕਿ ਕਿਹੜੀ ਕਿਹੜੀ ਟੈਕਨੋਲੋਜੀ ਚੱਲ ਰਹੀ ਆ ਮਾਰਕੀਟ ਵਿੱਚ ਅਤੇ ਕਿਹਨਾਂ ਟੈਕਨੋਲਜੀਆਂ ਦਾ ਉਹਨਾਂ ਨੂੰ ਫਾਇਦਾ ਅਤੇ ਕਿਹਨਾਂ ਦਾ ਨਹੀਂ ਤਾਂ ਸੋ ਦੈ ਅ ਸੋ ਤੈਕਨੋਲੋਜੀ ਜਿਹੜਾ ਸਾਡੇ ਖਰੀਦਦਾਰੀ ਦੇ ਤਰੀਕੇ ਵਿੱਚ ਬਹੁਤ ਚੇਂਜਜ ਲਾਏ ਹਨ ਪਹਿਲਾਂ ਆਪਾਂ ਬਸ ਅੱਖਾਂ ਬੰਦ ਕਰਕੇ ਕੁਛ ਨਾ ਕੁਛ ਖਰੀਦਦੇ ਸੀ ਪਰ ਹੁਣ ਅਸੀਂ ਸਹੀ ਥਾਂ 'ਤੇ ਆਪਣੇ ਪੈਸੇ ਲਾ ਸਕਦੇ ਹਨ ਇਹਨਾਂ ਟੈਕਨੋਲੋਜੀਸ ਨੂੰ ਯੂਜ਼ ਕਰਕੇ